ਥਾਂ 'ਤੇ ਫੋਟੋਆਂ ਲੈਣਾ ਇੱਕ ਆਮ ਗੱਲ ਹੋ ਗਈ ਹੈ ਮੋਬਾਇਲ ਫੋਨ ਹੱਥ ਵਿਚ ਹੋਣ ਕਰਕੇ ਬੰਦਾ ਹਰ ਮੌਕੇ ਨੂੰ ਫੋਟੋ ਦੇ ਰੂਪ ਵਿੱਚ ਕੈਦ ਕਰ ਲੈਂਦਾ ਪਰ ਕੁਛ ਕੁ ਫੋਟੋਆਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀ ਯਾਦਗਾਰ ਬਣ ਜਾਂਦੀਆਂ ਨੇ ਜਿੱਦਾਂ ਕਿ ਬੰਦੇ ਦੀ ਕੋਈ ਵਿਸ਼ੇਸ਼ ਜਰਨੀ ਇੱਕ ਹੋਈ ਹੋਵੇ ਕਿਤੇ ਯਾਤਰਾ ਕੀਤੀ ਹੋਵੇ ਉੱਥੇ ਖਿੱਚੀ ਗਈ ਫੋਟੋ ਉਹਨੂੰ ਉਹ ਪਲ ਯਾਦ ਕਰਾਉਂਦੀ ਹੈ ਇੱਦਾਂ ਹੀ ਮੇਰੀ ਇੱਕ ਕੇਰਲਾ ਦੀ ਟ੍ਰਿਪ ਸੀਗੀ ਜਿੱਥੇ ਅਸੀਂ ਪਹਾੜਾਂ 'ਤੇ ਜਾ ਕੇ ਇੱਕ ਫੋਟੋ ਖਿੱਚੀ ਸੀਗੀ ਉਹ ਫੋਟੋ ਮੇਰੀ ਯਾਦਗਾਰ ਫੋਟੋ ਹੈ ਕਿਉਂਕਿ ਉਹ ਮੇਰਾ ਪਹਿਲਾ ਟ੍ਰਿਪ ਸੀਗਾ